ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਮੈਂ ਔਨਲਾਈਨ ਹੈਡਫੋਨ ਮੰਗਵਾਏ ਸੀ ਅਤੇ ਮੈਂ ਸੋਚਿਆ ਸੀ ਕਿ ਔਨਲਾਈਨ ਮੈਨੂੰ ਪਹਿਲਾਂ ਔਨਲਾਈਨ ਮੰਗਵਾਉਣ ਤਾਂ ਕਾਫ਼ੀ ਦਿੱਕਤ ਹੁੰਦੀ ਸੀ ਕਿ ਲੋਕ ਕਹਿੰਦੇ ਹਨ ਕਿ ਨਹੀਂ ਸਹੀ ਚਲਦੇ ਮੈਨੂੰ ਲੱਗਦਾ ਸੀ ਕਿ ਯਾਰ ਇੱਦਾਂ ਥੋੜ੍ਹੀ ਕੋਈ ਰੱਖਦਾ ਸਹੀ ਚਲਦੇ ਹੋਣ ਤੱਦੇ ਤਾਂ ਰੱਖਦਾ ਪਰ ਜਦੋਂ ਮੈਂ ਮੰਗਵਾਏ ਐਕਸਪੀਰੀਅੰਸ ਕੀਤਾ ਹੈਡਫੋਨ ਮੰਗਵਾਏ ਹੈਡਫੋਨ ਜੋ ਕੁਆਲਿਟੀ ਉਹ ਦਿਖਾਉਂਦੇ ਹਨ ਉਹ ਭੇਜਦੇ ਨੀਗੇ ਉਹ ਕੁਆਲਿਟੀ ਜਿਹੜੀ ਮੈਨੂੰ ਆਈ ਉਹ ਕਾਫ਼ੀ ਖਰਾਬ ਸੀ ਉਹਦੀ ਅਵਾਜ਼ ਮੈਨੂੰ ਨਹੀਂ ਸਹੀ ਲੱਗੀ ਉਹਦਾ ਜਿਹੜਾ ਕੰਨਫਰਟ ਹੈ ਸੀ ਉਹ ਆ ਉਹ ਨਹੀਂ ਸਹੀ ਸੀ ਉਹਦੀ ਮਤਲਬ ਕਿ ਜਿਹੜੀ ਉਹ ਕਨੈਕਟ ਹੋਣ 'ਤੇ ਕਾਫ਼ੀ ਦਿੱਕਤ ਕਰਦਾ ਪਿਆ ਸੀ ਪਹਿਲਾਂ ਤਾਂ ਜਦੋਂ ਮਤਲਬ ਕਿ ਮੈਂ ਯੂਜ ਕਰਦਾ ਸੀ ਅਤੇ ਉਹਦੀ ਆਵਾਜ਼ ਬਿਲਕੁਲ ਗਾਣਾ ਜਿਹੜਾ ਮੈਂ ਸੁਣਦਾ ਜਾਂ ਕੋਈ ਚੀਜ਼ ਕਰਦਾ ਸੀ ਉਹ ਆਵਾਜ਼ ਬਿਲਕੁਲ ਸਹੀ ਨਹੀਂ ਆਉਂਦੀ ਸੀ ਮੈਂ ਇਹ ਹੀ ਕਹਿਣਾ ਚਾਹਵਾਂਗਾ ਕਿ ਜਿਹੜੇ ਇਹ ਕੰਪਨੀਆਂ ਹਨ ਜਿਹੜੇ ਇਹ ਹੈਡਫੋਨ ਬਣਾਉਂਦੇ ਹਨ ਇੰਨੇ ਇੰਨੇ ਮਹਿੰਗੇ ਹੈਡਫੋਨ ਵੇਚਦੇ ਹਨ ਅਤੇ ਇਹਨਾਂ ਨੂੰ ਆਪਣਾ ਯੂਜ ਕਰਨਾ ਚਾਹੀਦਾ ਕਿ ਹੈਡਫੋਨ ਉਹ ਸਹੀ ਵੇਚਣ ਅਗਰ ਤੁਸੀਂ ਮਹਿੰਗੀ ਚੀਜ਼ ਵੇਚਦੇ ਪਏ ਹੋ ਤਾਂ ਸਹੀ ਜ਼ਰੂਰ ਵੇਚੋ ਉਹ ਖਰਾਬ ਚੀਜ਼ਾਂ ਵੇਚੀ ਜਾਂਦੇ ਹਨ ਅਤੇ ਔਨਲਾਈਨ ਲੋਕ ਮੰਗਵਾਉਂਦੇ ਹਨ ਅਤੇ ਫਿਰ ਮੈਨੂੰ ਰੋਕਣ ਦਿੱਕਤ ਹੁੰਦੀ ਹੈ ਅਤੇ ਇਹਨਾਂ ਦਾ ਇਹ ਹੀ ਚੀਜ਼ਾਂ ਕਰਕੇ ਉਹਨਾਂ ਦੀ ਜਿਹੜੀ ਹੈਗੀ ਆ ਜਿਹੜੀ ਜਿਹੜੀ ਉਹਨਾਂ ਦੀ ਲੈਵਲ ਹੈਗਾ ਘੱਟ ਰਿਹਾ ਮੈਂ ਹੁਣ ਜਿਹੜੀ ਚੀਜ਼ ਮੰਗਵਾਈ ਸੀ ਉਹਦਾ ਰਿਪਲੇਸਮੈਂਟ ਕਰਤਾ ਹੈ ਮੈਂ ਮੈਨੂੰ ਚੀਜ਼ ਨਹੀਂ ਸੀ ਲੱਗੀ ਮੈਨੂੰ ਉਹ 'ਚ ਕਾਫ਼ੀ ਦਿੱਕਤ ਆਈ ਮੈਨੂੰ ਬੋਲਣ 'ਚ ਕਾਫ਼ੀ ਦਿੱਕਤ ਆਈ ਉਹ 'ਚ ਇੱਕ ਤਾਂ ਸਪੀਕਰ ਉਹਦਾ ਸਪੀਕਰ ਨਹੀਂ ਸਹੀ ਅੜ ਅੜ ਕੇ ਆਵਾਜ਼ ਆਉਂਦੀ ਸੀ ਉਹਦੀ ਆਵਾਜ਼ ਅੱਗੇ ਪਿੱਛੇ ਹੁੰਦੀ ਸੀ ਜੋ ਮੈਂ ਬੋਲਦਾ ਸੀ ਥੋੜ੍ਹਾ ਲੇਟ ਜਾਂਦਾ ਸੀ ਅਗਲੇ ਦੀ ਆਵਾਜ਼ ਮੈਨੂੰ ਲੇਟ ਆਉਂਦੀ ਸੀ ਮੈਨੂੰ ਉਹ 'ਚ ਕਾਫ਼ੀ ਦਿੱਕਤ ਆ ਰਹੀ ਸੀ ਇਸ ਕਰਕੇ ਰਿਪਲੇਸਮੇਂਟ ਅਤੇ ਮੈਂ ਇਹ ਹੀ ਕਹਿਣਾ ਚਾਹਵਾਂਗਾ ਕਿ ਜਿਹੜੇ ਕੰਪਨੀਆਂ ਹਨ ਉਹਨਾਂ ਨੂੰ ਆਪਣੀ ਜਿਹੜੀ ਚੀਜ਼ਾਂ ਹਨ ਉਹ ਸਹੀ ਦਿਤੀ ਭੇਜਣੀਆਂ ਚਾਹੀਦੀਆਂ ਕਿਉਂਕਿ ਉਹ ਪੈਸੇ ਬਹੁਤ ਲੈ ਲੈਂਦੇ ਆ ਅਤੇ ਚੀਜ਼ ਬੇਕਾਰ ਭੇਜਦੇ ਹਨ